ਮੈਂ ਅੋਨਲਾਈਨ ਕੁਝ ਨਾ ਕੁਝ ਮੰਗਵਾਉਂਦਾ ਰਹਿੰਦਾ ਵਾ ਕਦੇ ਐਮਾਜੋਨ ਤੋਂ ਕਦੇ ਮੀਸ਼ੋ ਤੋਂ ਇਸ ਵਾਰ ਮੈਂ ਸੋਚਿਆ ਚੱਲ ਕੋਈ ਨਹੀਂ ਫਲਿੱਪਕਾਰਟ ਤੋਂ ਕੁਝ ਨਾ ਕੁਝ ਮੰਗਵਾਉਂਦੇ ਆ ਮੈਂ ਦੇਖਿਆ ਫਲਿਪਕਾਰਟ 'ਤੇ ਫੋਨਸ ਵਗੈਰਾ 'ਤੇ ਓਫਰ ਚੱਲਦੀ ਪਈ ਸੀ ਮੈਂ ਫੋਨ ਅੋਰਡਰ ਕ ਕੀਤਾ ਅਤੇ ਜਿਹੜੀ ਟੀ ਤਰੀਕ ਦਾ ਡਿਲੀਵਰੀ ਹੋਈ ਉਸ ਤਰੀਕ ਨੂੰ ਨਹੀਂ ਫੋਨ ਨਹੀਂ ਆਇਆ ਦੋ ਤਿੰਨ ਦਿਨ ਉਹ ਫਿਰ ਵੀ ਹੱਟ ਕੇ ਆਇਆ ਪਰ ਮੈਨੂੰ ਡਿਲੀਵਰੀ ਕੁਝ ਵਧੀਆ ਨਹੀਂ ਲੱਗੀ ਉਹਨਾਂ ਦੀ ਇੱਕ ਕਸਟਮਰ ਸਰਵਿਸ ਵੀ ਵਧੀਆ ਨਹੀਂ ਮੈਂ ਕੋਲ ਕਰਕੇ ਉਹਨਾਂ ਨੂੰ ਇੱਕ ਦੋ ਵਾਰ ਪੁੱਛਿਆ ਵੀ ਫੋਨ ਕਿੱਥੇ ਹੈਗਾ ਬਟ ਉਹ ਬੋਲੇ ਅਤੇ ਬੋਲ ਵੀ ਨਹੀਂ ਸਹੀ ਤਰ੍ਹਾਂ ਅਤੇ ਮੈਨੂੰ ਵਧੀਆ ਜਿਹਾ ਨਹੀਂ ਲੱਗਿਆ ਉਹਨਾਂ ਦਾ ਫੋਨ ਵੀ ਨਹੀਂ ਬ ਸਹੀ ਨਿਕਲਿਆ ਹੀਟ ਮਾਰਦਾ ਸੀ ਗਰਮ ਗੁਰਮ ਹੁੰਦਾ ਸੀ ਹੈਂਗ ਹੋਣ ਲੱਗ ਪਿਆ ਮੈਂ ਤਾਂ ਪਛਤਾਉਂਦਾ ਮੈਂ ਤਾਂ ਤਿੰਨ ਚਾਰ ਜਣਿਆਂ ਨੂੰ ਹੋਰ ਵੀ ਰੈਕਮੈਂਟ ਕਰੂੰਗਾ ਦੱਸੂਗਾ ਵੀ ਕਦੇ ਵੀ ਨਾ ਇਹਨਾਂ ਤੋਂ ਫੋਨ ਨਾ ਅੋਰਡਰ ਕਰਨਾ ਕਦੇ ਵੀ ਮੰਗਾਉਣ ਫੋਨ ਨਾ ਉਹਨਾਂ ਕਿਉਂਕਿ ਇਹ ਕਹਿੰਦੇ ਕੁਝ ਹੋਰ ਆ ਦੇ ਕੁਝ ਹੋਰ ਜਾਂਦੇ ਆ ਇਹਨਾਂ ਸਰਵਿਸ ਬਹੁਤ ਹੀ ਜ਼ਿਆਦਾ ਮਾੜੀ ਆ ਮੈਂ ਤਾਂ ਲੋਕਾਂ ਨੂੰ ਦੱਸਾਂਗਾ ਵੀ ਇਸ ਚਾਰਜੀਸ ਵੀ ਵ ਵੱਧ ਲਗਾਉਂਦੇ ਆ ਪਰ ਚੀਜ਼ ਵੀ ਵਧੀਆ ਨਹੀਂ ਦਿੰਦੇ ਇਹਨਾਂ ਨਾਸ ਨਾਲੋਂ ਤਾਂ ਐਮਾਜੋਨ ਵਾਲੇ ਵਧੀਆ ਹੈਗੇ ਆ